ਜਿਵੇਂ ਕਿ ਕਹਿੰਦੇ ਨੇ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਨਸਾਨ ਨੂੰ ਜਦੋਂ ਵੀ ਮੌਕਾ ਮਿਲੇ ਉਸ ਨੂੰ ਸਿੱਖਣਾ ਚਾਹੀਦਾ ਹੈ ਕਿਸੇ ਤਰ੍ਹਾਂ ਬੱਚ ਇਸੇ ਤਰ੍ਹਾਂ ਬੱਚਿਆਂ ਲਈ ਵੀ ਡਰਾਇੰਗ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਬੱਚੇ ਬਚਪਨ ਤੋਂ ਹੀ ਸਿੱਖਣਾ ਸ਼ੁਰੂ ਕਰ ਸਕਦੇ ਹਨ ਕਿਉਂਕਿ ਡਰਾਇੰਗ ਸਿੱਖ ਡਰਾਇੰਗ ਸਿੱਖਣ ਇੱਕ ਇਹੋ ਜਿਹਾ ਵਿਸ਼ਾ ਹੈ ਜੋ ਕਿ ਜਿੰਨੀ ਜ਼ਿਆਦਾ ਪ੍ਰੈਕਟਿਸ ਕਰਾਂਗੇ ਉਨੀ ਹੀ ਜ਼ਿਆਦਾ ਸਫਾਈ ਅਤੇ ਨਿਖਰ ਕੇ ਹੁਨਰ ਬਾਹਰ ਆਉਂਦਾ ਹੈ ਅਤੇ ਬਚਪਨ ਹੀ ਇੱਕ ਇਹੋ ਜਿਹੀ ਉਮਰ ਹੈ ਜਿਸ ਵਿੱਚ ਬੱਚੇ ਜਿੱਧਰ ਚਾਹੇ ਆਪਣਾ ਧਿਆਨ ਕਰਕੇ ਉਸ ਵਿੱਚ ਨਿਪੁੰਨਤਾ ਪ੍ਰਾਪਤ ਕਰ ਸਕਦੇ ਨੇ ਇਸ ਉਮਰ ਵਿੱਚ ਹਰ ਬੱਚੇ ਜਿਸ ਕੰਮ ਵਿੱਚ ਦਿਲਚਸਪੀ ਲੈਣ ਉਸੇ ਵਿੱਚ ਬਹੁਤ ਵੱਡੀ ਮਹ ਮਹਾਰਤ ਪ੍ਰਾਪਤ ਕਰ ਸਕਦੇ ਹਨ ਇਸ ਲਈ ਮੇਰੇ ਹਿਸਾਬ ਨਾਲ ਬਚਪਨ ਸਭ ਤੋਂ ਵਧੀਆ ਉਮਰ ਹੈ ਬੱਚਿਆਂ ਲਈ ਡਰਾਇੰਗ ਸਿੱਖਣ ਲਈ